ਇੱਕ ਅਕਤੂਬਰ ਦੋ ਹਜ਼ਾਰ ਤੇਰ੍ਹਾਂ ਇੱਕ ਅਗਸਤ ਦੋ ਹਜ਼ਾਰ ਚਾਰ ਚਾਰ ਅਕਤੂਬਰ ਦੋ ਹਜ਼ਾਰ ਤਿੰਨ ਛੇ ਜਨਵਰੀ ਦੋ ਹਜ਼ਾਰ ਸੱਤ ਸੋਲ੍ਹਾਂ ਜ ਜਨਵਰੀ ਦੋ ਹਜ਼ਾਰ ਛੇ